ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਕੌਣ ਸੀ ਕਲਾਸ 'ਚ ਹਾਂਜੀ ਹਾਂਜੀ ਦੱਸੋ ਸਰ ਇੰਨੇ ਦਿਨ ਤਾਂ ਜ਼ਿਆਦਾ ਨਹੀਂ ਹੋ ਜਾਣਗੇ ਸਰ ਫਿਰ ਉਹ ਕੰਮ ਕਿਸ ਤਰ੍ਹਾਂ ਕਰੇਗਾ ਤੁਸੀਂ ਦੱਸੋ ਨਾ ਸਕੂਲ ਦਾ ਹੋਮਵਰਕ ਹੈ ਸਕੂਲ ਕਲਾਸ ਵਰਕ ਹੈ ਉਹ ਕਿੱਦਾਂ ਕਰੇਗਾ ਦੇਖ ਲਓ ਵੈਸੇ ਇੰਨੀ ਛੁੱਟੀਆਂ ਹੋ ਨਹੀਂ ਸਕਦੀਆਂ ਜੇ ਥੋੜ੍ਹੇ ਘੱਟ ਕਰ ਦਿਉ ਤਾਂ ਵਧੀਆ ਰਹੇਗਾ ਤੁਹਾਡੇ ਲਈ ਵੀ ਚਲੋ ਦੇਖਦੇ ਹਾਂ ਹਾਂਜੀ ਚਲੋ ਠੀਕ ਹੈ ਜੇ ਤੁਸੀਂ ਕੰਮ ਕਰਵਾ ਦਿਉਗੇ ਤਾਂ ਠੀਕ ਹੈ ਨਹੀਂ ਤਾਂ ਤੁਹਾਡੇ ਬੱਚੇ ਦੀ ਪੜ੍ਹਾਈ ਪਿੱਛੇ ਪੈਣੀ ਹੈ ਠੀਕ ਹੈ ਫਿਰ ਮੈਂ ਕਰ ਦਿੰਦੀ ਓਕੇ